ਅੱਜ ਭਾਰਤ ਦੇ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਕਾਫੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਆਪਾਂ ਦੇਖ ਹੀ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਕਿੰਨਾ ਵਾਯੂ ਪ੍ਰਦੂਸ਼ਣ ਹੋ ਚੁੱਕਿਆ ਹੈ ਉੱਥੇ ਸਾਹ ਲੈਣਾ ਸਤਾਰਾਂ ਵੀਹ ਬੀੜੀਆਂ ਫੂਕਣ ਦੇ ਬਰਾਬਰ ਹੈ ਸਿਰਫ ਵਾਯੂ ਪ੍ਰਦੂਸ਼ਣ ਹੀ ਨਹੀਂ ਉੱਥੇ ਪਾਣੀ ਪ੍ਰਦੂਸ਼ਣ ਵੀ ਹੋ ਚੁੱਕਿਆ ਹੈ ਇਹ ਸਭ ਉੱਥੇ ਫੈਕਟਰੀ ਕਰਕੇ ਹੋਇਆ ਹੈ ਇਹ ਫੈਕਟਰੀਆਂ ਆਪਣਾ ਸਾਰਾ ਰਸਾਇਣਿਕ ਸਮਾਨ ਪਾਣੀ ਵਿੱਚ ਸੁੱਟ ਦਿੰਦੀ ਹੈ ਜੋ ਅੱਗੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ ਮੈ ਦੇਖ ਸਕਦਾ ਹਾਂ ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਮੇਰੇ ਲਾਗੇ ਵਾਲੀ ਫ਼ਸਲਾਂ ਕਾਫੀ ਵਧੀਆ ਹੁੰਦੀ ਸੀ ਉਦੋਂ ਕਿਸਾਨ ਆਪਣੀ ਉਪਜ ਲਈ ਪ੍ਰਾ ਪ੍ਰਕ੍ਰਿਤਿਕ ਚੀਜ਼ਾਂ ਵਰਤਦੇ ਸੀ ਪਰ ਹੁਣ ਕਿਸਾਨਾਂ ਨੇ ਰਸਾਇਣਿਕ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹੈ ਜਿਸ ਕਰਕੇ ਉਸ ਦਾ ਸਾਰਾ ਨਿਊਟ੍ਰੀਸ਼ਨ ਵਾਲਾ ਖਤਮ ਹੋ ਚੁੱਕਿਆ ਹੈ ਅਤੇ ਉਹ ਸਾਡੇ ਸਰੀਰ ਲਈ ਵੀ ਇੰਨਾ ਵਧੀਆ ਨਹੀਂ ਰੱਖਦਾ ਹੋਰ ਜੇ ਆਪਾਂ ਵੇਖੇ ਤਾਂ ਮੌਸਮ ਦੇ ਵਿੱਚ ਕਾਫੀ ਚੇਂਜਿਸ ਹੋ ਚੁੱਕੇ